ਮਾਰਸ਼ਲ ਆਰਟਸ ਨੇ ਮੇਰੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਪਹਿਲਾਂ ਮੇਰੀ ਸਿਹਤ ਬਹੁਤ ਕੁਛ ਠੀਕ ਨਹੀਂ ਸੀ ਜਦੋਂ ਤੋਂ ਮੈਂ ਮਾਰਸ਼ਲ ਆਰਟਸ ਨੂੰ ਸ਼ੁਰੂ ਕੀਤਾ ਹੈ ਇਸ ਦੇ ਨਾਲ ਮੇਰੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਿੱਚ ਬਹੁਤ ਵਾਧਾ ਹੋਇਆ ਹੈ ਅੱਜ ਮੈਂ ਆਪਣੇ ਆਪ ਨੂੰ ਤੰਦਰੁਸਤ ਸਮਝਦੀ ਹਾਂ ਇਹ ਸਭ ਮਾਰਸ਼ਲ ਆਰਟਸ ਦੀ ਦੇਣ ਹੈ